ਯੋਗਾ ਸਾਡੇ ਸਰੀਰ ਵਾਸਤੇ ਬਹੁਤ ਲਾਭਦਾਇਕ ਹੈ ਯੋਗ ਯੋਗਾ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਯੋਗਾ ਕਰਨ ਨਾਲ ਕਈ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ ਯੋਗਾ ਕਰਨ ਨਾਲ ਸਾਡੇ ਸਰੀਰ ਵਿੱਚ ਸਫੁਰਤੀ ਆਉਂਦੀ ਹੈ ਯੋਗਾ ਕਰਨ ਨਾਲ ਸਾਨੂੰ ਆਪਣਾ ਸਮੇਂ ਬੜਾ ਅੱਛਾ ਬਤੀਤ ਹੁੰਦਾ ਹੈ ਯੋਗਾ ਕਰਨ ਨਾਲ ਸਾਨੂੰ ਕਈ ਕਈ ਬਿਮਾਰੀਆਂ ਦੀ ਬਿਮਾਰੀਆਂ ਦੀ ਬੱਚਤ ਹੋ ਜਾਂਦੀ ਹੈ ਯੋਗਾ ਤੋਂ ਸਾਨੂੰ ਇਹ ਸਬਕ ਮਿਲਦਾ ਹੈ ਕਿ ਯੋਗਾ ਕਰਨ ਨਾਲ ਅਸੀਂ ਸਫੁਰਤ ਰਹਿੰਦੇ ਹਾਂ ਅਸੀਂ ਹਰ ਸਾਰੇ ਦਿਨ ਦਾ ਕੰਮ ਬੜੀ ਅਸੀਂ ਤਰੱਕੀ ਨਾਲ ਕਰ ਸਕਦੇ ਹਾਂ